ਸਤਿ ਸ਼੍ਰੀ ਅਕਾਲ ਜੀ ਹਾਂਜੀ ਅਸੀਂ ਤੁਹਾਡੀ ਕੀ ਸੇਵਾ ਕਰ ਸਕਦੇ ਹਾਂ ਹਾਂਜੀ ਹਾਂਜੀ ਹਾਂਜੀ ਥੈਂਕ ਯੂ ਓਕੇ ਥੈਂਕ ਯੂ ਹਾਂਜੀ ਸਾਡੇ ਹੋਟਲਜ਼ ਦੇ ਵਿੱਚ ਡਿਸਕਾਊਂਟ ਔਫਰ ਚੱਲਦੇੇ ਰਹਿੰਦੇ ਹੈ ਜਿਵੇਂ ਕਿ ਸੀਜ਼ਨਲੀ ਔਰ ਫੈਸਟੀਵਲਜ਼ ਦੇ ਵਿੱਚ ਵੀ ਔਰ ਮਨਥ ਦੇ ਐਂਡ ਵਿੱਚ ਵੀ ਜਦੋਂ ਵੀ ਕਦੋਂ ਸਾਨੂੰ ਡਿਸਕਾਊਂਟ ਔਫਰਜ਼ ਔਫਰਜ਼ ਮੈਂ ਤੁਹਾਨੂੰ ਕਰਨਾ ਚਾਹੁੰਗੀ ਤਾਂ ਤੁਸੀਂ ਮੈਨੂੰ ਆਪਣਾ ਵੱਟਸਐਪ ਨੰਬਰ ਦੇ ਦਿਓ ਤਾਂ ਫਿਰ ਮੈਂ ਤੁਹਾਨੂੰ ਤੁਹਾਡੇ ਨਾਲ਼ ਵੱਟਸਐਪ 'ਤੇ ਵੀ ਸ਼ੇਅਰ ਕਰਦੂਂਗੀ ਅਤੇ ਤੁਸੀਂ ਸਾਡੇ ਹੋਟੇਲ ਦੀ ਸਾਈਟ ਵੀ ਵਿਜ਼ਿਟ ਕਰ ਸਕਦੇ ਆ ਮਤਲਬ ਤੁਹਾਨੂੰ ਉਸਤੇ ਸਭ ਕੁਝ ਪਰੋਪਰ ਜੋ ਸਾਡੇ ਹੋਟੇਲਜ਼ ਦੇ ਰੂਮਜ਼ ਦੇ ਅਕੋਡਿੰਗ ਤੁਹਾਨੂੰ ਡਿਸਕਾਊਂਟ ਹੈ ਜੋ ਅਸੀਂ ਦਿੰਦੇ ਹੁੰਦੇ ਹਾਂ ਅਤੇ ਤੁਸੀਂ ਰੂਮਜ਼ ਦੇ ਅਕੋਡਿੰਗ ਹੈ ਜੋ ਡਿਸਕਾਊਂਟ ਤੁਹਾਨੂੰ ਮਿਲੂਗਾ ਜਾਂ ਫੈਸਟੀਵਲਜ਼ ਦੇ ਅਕੋਡਿੰਗ ਤੁਹਾਨੂੰ ਡਿਸਕਾਊਂਟ ਮਿਲੂਗਾ ਅਤੇ ਤੁਹਾਨੂੰ ਤੁਸੀਂ ਆਪਣੀ ਸਾਡੀ ਸਾਈਟ ਹੈ ਉਸ ਤੋਂ ਵਿਜ਼ਿਟ ਕਰਿਓ ਹਾਂਜੀ ਉਹ ਤੁਹਾਡੀ ਸਰਵਿਸ ਆ ਜੋ ਤੁਸੀਂ ਉਹਦੇ ਬਾਰੇ ਗੱਲ ਬਾਤ ਤੁਸੀਂ ਸਾਡੇ ਹੋਟੇਲ ਆ ਕੇ ਕਰ ਸਕਦੇ ਹੋ ਜੋ ਵੀ ਤੁਹਾਨੂੰ ਕੋਐਰਿਜ਼ ਹੈ ਤੁਸੀਂ ਸਾਡੇ ਨਾਲ਼ ਆ ਕੇ ਗੱਲ ਬਾਤ ਕਰ ਸਕਦੇ ਹੋ ਓਕੇ ਥੈਂਕ ਯੂ